ਸਾਡੇ ਦੇਸ਼ ਵਿੱਚ ਮੁੱਖ ਤੌਰ 'ਤੇ ਚਾਰ ਧਰਮਾਂ ਦਾ ਜ਼ਿਕਰ ਆਉਂਦਾ ਹੈ ਉਸਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਇਸਾਈ ਵੈਸੇ ਤਾਂ ਜੈਨ ਧਰਮ ਬੁੱਧ ਧਰਮ ਇਸਦੇ ਵੀ ਹੁਣ ਬਹੁਤ ਜ਼ਿਆਦਾ ਲੋਕ ਹੋ ਗਏ ਹਨ ਪਰ ਜ਼ਿਆਦਾਤਰ ਸਾਡੇ ਇਲਾਕੇ ਦੇ ਵਿੱਚ ਮੰਦਰ ਹਨ ਜਿੱਥੇ ਕਿ ਬਹੁਤ ਜ਼ਿਆਦਾ ਕੀਰਤਨ ਕੀਤਾ ਜਾਂਦਾ ਹੈ ਭਜਨ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਸਾਡੇ ਇਲਾਕੇ ਦੇ ਵਿੱਚ ਸਾਡਾ ਫਤਿਹਗੜ੍ਹ ਜਿਹੜਾ ਜ਼ਿਲ੍ਹਾ ਹੈ ਉਸ ਦੇ ਵਿੱਚ ਜਿਹੜਾ ਹੈ ਮੇਨ ਜਿਹੜਾ ਹੈ ਉਹ ਗੁਰਦੁਆਰਾ ਹੈ ਗੁਰਦੁਆਰਾ ਸਾਹਿਬ ਹੈ ਇੱਥੇ ਸਾਡੇ ਕੋਲ ਦੋ ਜਿਹੜੇ ਨੇ ਮੇਨ ਗੁਰਦੁਆਰੇ ਨੇ ਇਹਨਾਂ ਦੋ ਗੁਰਦੁਆਰਿਆਂ ਦੇ ਵਿੱਚ ਇੱਕ ਥਾਂ ਦੇ ਉੱਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਕਿ ਸਿੱਖਾਂ ਦੇ ਦਸਵੇਂ ਗੁਰੂ ਸਨ ਉਹਨਾਂ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਅਤੇ ਦੂਸਰੀ ਥਾਂ ਦੇ ਉੱਤੇ ਜਿਹੜਾ ਕਿ ਜੋਤੀ ਸਰੂਪ ਗੁਰਦੁਆਰਾ ਹੈ ਉੱਥੇ ਉਹਨਾਂ ਦਾ ਸਸਕਾਰ ਕੀਤਾ ਗਿਆ ਸੀ ਇਹ ਦੋ ਜਿਹੜੇ ਆ ਸਾਡੇ ਧਾਰਮਿਕ ਅਸਥਾਨ ਨੇ ਇਹਨਾਂ ਅਸਥਾਨਾਂ ਦੇ ਵਿੱਚ ਹਮੇਸ਼ਾਂ ਹੀ ਪਾਠ ਕੀਰਤਨ ਚਲਦਾ ਰਹਿੰਦਾ ਹੈ ਅਤੇ ਬਹੁਤ ਸਾਰੇ ਲੋਕ ਵੱਖ ਵੱਖ ਥਾਵਾਂ ਤੋਂ ਆ ਕੇ ਇਹਨਾਂ ਦੇ ਦਰਸ਼ਨ ਕਰਦੇ ਹਨ ਇਸੇ ਤਰ੍ਹਾਂ ਸਾਡੇ ਇਲਾਕੇ ਦੇ ਵਿੱਚ ਮੈਂ ਇੱਥੇ ਸਰਹੰਦ ਦੀ ਗੱਲ ਕਰ ਰਹੀ ਹਾਂ ਉਸ ਜਗ੍ਹਾ ਦੇ ਉੱਤੇ ਬਹੁਤ ਸਾਰੇ ਮੰਦਰ ਹਨ ਉਹ ਮੰਦਰਾਂ ਦੇ ਵਿੱਚ ਵੀ ਹਮੇਸ਼ਾਂ ਭਜਨ ਕੀਰਤਨ ਚੱਲਦਾ ਰਹਿੰਦਾ ਹੈ ਸਾਡੇ ਕੋਲ ਇੱਥੇ ਇੱਕ ਦਰਗਾਹ ਵੀ ਹੈ ਰੋਜ਼ਾ ਸ਼ਰੀਫ ਜਿਨ੍ਹਾਂ ਜਿਸਦੀ ਕਿ ਬਹੁਤ ਜ਼ਿਆਦਾ ਮਾਨਤਾ ਹੈ ਉੱਥੇ ਵੀ ਹਮੇਸ਼ਾਂ ਇਕੱਠ ਰਹਿੰਦਾ ਹੈ ਇਸ ਤਰ੍ਹਾਂ ਜੇ ਮੈਂ ਚਰਚ ਦੀ ਗੱਲ ਕਰਾਂ ਤਾਂ ਸਾਡੇ ਕੋਲ ਇੱਥੇ ਇੱਕ ਚਰਚ ਵੀ ਹੈ ਉਸ ਚਰਚ ਦੇ ਵਿੱਚ ਵੀ ਐਤਵਾਰ ਨੂੰ ਪ੍ਰਾਰਥਨਾ ਸਭਾ ਕੀਤੀ ਜਾਂਦੀ ਹੈ ਅਤੇ ਜਿਹੜੇ ਉਸ ਧਰਮ ਦੇ ਨਾਲ ਸੰਬੰਧਿਤ ਲੋਕ ਹਨ ਉਹ ਸਾਰੇ ਉੱਥੇ ਜਾ ਕੇ ਆਪਣੇ ਈਸ਼ਵਰ ਦੇ ਅੱਗੇ ਨਮਸਤਕ ਹੁੰਦੇ ਹਨ ਸਾਡੇ ਸ਼ਹਿਰ ਸਰਹੰਦ ਦੀ ਜੇ ਮੈਂ ਗੱਲ ਕਰ ਰਹੀ ਹਾਂ ਤਾਂ ਉਸ ਸ਼ਹਿਰ ਦੇ ਵਿ ਦਾ ਬਹੁਤ ਹੀ ਇਤਿਹਾਸਿਕ ਜਿਹੜੀ ਹੈ ਉਹਦੀ ਮਹਾਨਤਾ ਵੀ ਹੈ ਉਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਸਾਰੇ ਧਾਰਮਿਕ ਅਸਥਾਨਾਂ ਦੇ ਉੱਤੇ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ